ਹੈਲੋ ਹਾਂਜੀ ਹਰਵਿੰਦਰ ਸਿੰਘ ਜੀ ਹਾਂਜੀ ਇੱਕ ਸਰ ਸਾਡੀ ਅੰਕੜਾ ਵਿਗਿਆਨ ਵਿਭਾਗ ਤੋਂ ਬੋਲ ਰਹੇ ਹਾਂ ਅਸੀਂ ਅੰਕੜਾ ਵਿਗਿਆਨੀ ਮੈਂ ਪਰਮਿੰ ਹਾਂਜੀ ਸੁਰਿੰਦਰ ਸਿੰਘ ਬੋਲ ਰਿਹਾ ਮੈਂ ਇੱਕ ਸਰ ਸਾਡੀ ਡਿਊਟੀ ਲੱਗੀ ਹੈ ਜੀ ਆਰਥਿਕ ਸਰਵੇਖਣ ਦੇ ਸੰਬੰਧ ਵਿੱਚ ਤਾਂ ਉਹਦੇ ਸੰਬੰਧ ਦੇ ਵਿੱਚ ਤੁਹਾਨੂੰ ਫੋਨ ਕੀਤਾ ਸੀਗਾ ਉਮੀਦ ਹੈ ਵੀ ਥੋੜ੍ਹੀ ਜਿਹੀ ਇੱਥੇ ਜਾਣਕਾਰੀ ਤੁਹਾਡੇ ਨਾਲ ਲੈਣੀ ਚਾਹੁੰਦੇ ਹਾਂ ਤੁਹਾਡੇ ਤੋਂ ਅਤੇ ਉਮੀਦ ਹੈ ਵੀ ਸਾਨੂੰ ਸਹਿਯੋਗ ਦਿਓ ਤੁਸੀਂ ਹਾਂਜੀ ਆਰਥਿਕ ਸਰਵੇਖਣ ਦੇ ਸੰਬੰਧ ਸਰ ਆਪਣਾ ਅਸੀਂ ਤੁਹਾਨੂੰ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਬੀ ਕਾਰੋਬਾਰ ਸਰ ਕੀ ਆਪਣਾ ਪ੍ਰੋਫੈਸ਼ਨ ਆਪਣਾ ਆਕੂਪੇਸ਼ਨ ਠੀਕ ਹੈ ਪ੍ਰਾਈਵੇਟ ਸਕੂਲ ਦੇ ਵਿੱਚ ਠੀਕ ਠੀਕ ਠੀਕ ਅਤੇ ਕੀ ਮੈਂ ਜਾਣ ਸਕਦਾ ਸਰ ਵੀ ਉੱਥੋਂ ਤੁਹਾਨੂੰ ਕਿੰਨੀ ਆਮਦਨੀ ਹੋ ਜਾਂਦੀ ਹੈ ਧੰਦਾ ਰਿਹਾ ਨਹੀਂ ਹੁਣ ਬਿਲਕੁਲ ਠੀਕ ਹੈ ਜੀ ਹਾਂਜੀ ਪ੍ਰਾਪਤ ਹੋ ਜਾਂਦਾ ਠੀਕ ਹੈ ਸਰ ਅਤੇ ਹੋਰ ਸਰ ਇਸ ਤੋਂ ਇਲਾਵਾ ਕੋਈ ਕਿਸੇ ਤਰ੍ਹਾਂ ਦੀ ਆਮਦਨ ਤੁਹਾਨੂੰ ਤਾਂ ਪਰਿਵਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦੁਕਾਨ ਜਾਂ ਘਰ ਦਾ ਕੋਈ ਹੋਰ ਮੈਂਬਰ ਜਾਂ ਆਮਦਨ ਹੋਵੇ ਠੀਕ ਹੈ ਜੀ ਕੁੱਲ ਮਿਲਾ ਕੇ ਸਾਲਾਨਾ ਅਸੀਂ ਕਹਿ ਸਕਦੇ ਹਾਂ ਵੀ ਸੱਠ ਤੋਂ ਸੱਤਰ ਹਜ਼ਾਰ ਤੁਹਾਨੂੰ ਆਮਦਨ ਹੈ ਸਾਲਾਨਾ ਸਾਲਾਨਾ ਠੀਕ ਠੀਕ ਠੀਕ ਠੀਕ ਹੈ ਅਤੇ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਸਰ ਆਪਣੇ ਨੌ ਮੈਬਰ ਠੀਕ ਹੈ ਜੀ ਨੌ ਮੈਂਬਰ ਅਤੇ ਆਮਦਨ ਤਕਰੀਬਨ ਪੰਝੱਤਰ ਅੱਸੀ ਹਜ਼ਾਰ ਰੁਪਇਆ ਠੀਕ ਹੈ ਜੀ ਅਤੇ ਸਾਧਨ ਸਰ ਆਪਣੇ ਕੋਲ ਹੋਏਗਾ ਜੀ ਕੋਈ ਡਿਉਟੀ 'ਤੇ ਜਾਣ ਲਈ ਜਾਂ ਘਰ ਦੇ ਵਿਚ ਰੱਖਿਆ ਹੁੰਦਾ ਜਿਵੇ ਆਪਾਂ ਕੋਈ ਕਾਰ ਕੋਈ ਸਕੂਟਰ ਹਾਂਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਅਤੇ ਘਰ ਦੇ ਵਿੱਚ ਸਰ ਆਪਣੇ ਇਲੈਕਟਰੋਨਿਕ ਇਕਉਪਮੈਂਟਸ ਵੀ ਹੋਣਗੇ ਜੀ ਬਿਜਲਈ ਯੰਤਰ ਆਪਣੇ ਫਰਿਜ ਕੂਲਰ ਏ ਸੀ ਉਹਦੇ ਸੰਬੰਧ ਦੇ ਵਿੱਚ ਥੋੜ੍ਹਾ ਜਿਹਾ ਅਸੀਂ ਹਾਂਜੀ ਠੀਕ ਹੈ ਓਕੇ ਜ਼ਰੂਰਤ ਵਾਲੀਆਂ ਚੀਜ਼ਾਂ ਜੋ ਹੈ ਉਹ ਆਪਣੀ ਹੈ ਸਾਰੀਆਂ ਠੀਕ ਹੈ ਜੀ ਅਤੇ ਬਾਕੀ ਸਰ ਫਰਨੀਚਰ ਸੋਫਾ ਬੈਡ ਠੀਕ ਹੈ ਜੀ ਓਕੇ ਠੀਕ ਹੈ ਠੀਕ ਠੀਕ ਠੀਕ ਅਤੇ ਠੀਕ ਹੈ ਜੀ ਅਤੇ ਇੱਕ ਸਰ ਘਰ ਦੱਸੋਗੇ ਜੀ ਮਤਲਬ ਆਪਣਾ ਜਾਂ ਕਿਰਾਏ ਦਾ ਜੀ ਅੱਛਾ ਕਿੰਨੇ ਸਰ ਗਜ਼ ਦੇ ਵਿੱਚ ਹੈ ਆਈਡੀਆ ਇਹ ਡੇਢ ਸੌ ਗਜ਼ ਦੇ ਵਿੱਚ ਠੀਕ ਹੈ ਸਰ ਜਿਹਦੇ ਵਿੱਚ ਨੌ ਮੈਂਬਰ ਆਪਾਂ ਨਿਵਾਸ ਕਰ ਰਹੇ ਹਾਂ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਜਾਣਕਾਰੀ ਦੇਣ ਲਈ ਧੰਨਵਾਦ ਸਰ ਓਕੇ ਜੀ ਓਕੇ